ਮੈਂ ਆਪਣੇ ਫੋਨ ਵਿੱਚ ਗੂਗਲ ਮੈਪ ਨਾਮ ਦੀ ਐਪ ਇੰਸਟੋਲ ਕੀਤੀ ਅਤੇ ਉਸ ਵਿੱਚ ਸਭ ਤੋਂ ਪਹਿਲਾਂ ਆਪਣੀ ਲੋਕੇਸ਼ਨ ਨੂੰ ਐਡ ਕੀਤਾ ਆਪਣੀ ਲੋਕੇਸ਼ਨ ਨੂੰ ਚਾਲੂ ਕੀਤਾ ਅਤੇ ਫਿਰ ਸਰਚ ਬਟਨ ਉੱਪਰ ਜਾ ਕੇ ਆਪਣੇ ਨੇੜੇ ਫਾਰਮੇਸੀਆਂ ਨੂੰ ਲੱਭਣਾ ਸ਼ੁਰੂ ਕੀਤਾ ਅਤੇ ਫਿਰ ਮੈਨੂੰ ਜੋ ਸਭ ਤੋਂ ਨੇੜੇ ਫਾਰਮੇਸੀ ਸੀ ਮੈਂ ਗੂਗਲ ਮੈਪ ਰਾਹੀਂ ਉਸ ਲੋਕੇਸ਼ਨ 'ਤੇ ਪਹੁੰਚ ਕੇ ਆਪਣੀ ਦਵਾਈ ਨੂੰ ਉਸ ਫੋਰਮੇਸੀ ਵਾਲਿਆਂ ਤੋਂ ਲੈ ਲਿਤਾ